ਔਨਲਾਈਨ ਸਕੂਲਿੰਗ ਅਤੇ ਕੋਚਿੰਗ ਨੇ ਬੱਚਿਆਂ ਦਾ ਜੀਵਨ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ ਹੈ ਜਿਵੇਂ ਬੱਚੇ ਜਿਵੇਂ ਜਿਵੇਂ ਫੋਨ ਦੀ ਵਰਤੋਂ ਕਰਦੇ ਜਾਂਦੇ ਆ ਜਿਹਨੂੰ ਅਸੀ ਬਲਿਊ ਲਾਈਟਿੰਗ ਕਹਿੰਦੇ ਆ ਬਲਿਊ ਲਾਈਟਿੰਗ ਦੇ ਕਾਰਨ ਫੋਨ ਦੀ ਜ਼ਿਆਦਾ ਵਰਤੋਂ ਦੇ ਕਾਰਨ ਬੱਚਿਆਂ ਦਾ ਜਿਹੜਾ ਆਈ ਕਿਊ ਲੈਵਲ ਹੈਗਾ ਉਹ ਬਹੁਤ ਜ਼ਿਆਦਾ ਘੱਟ ਜਾਂਦਾ ਹੈਗਾ ਬੱਚਿਆਂ ਦਾ ਜਿਹੜਾ ਦਿਮਾਗ਼ ਹੈਗਾ ਉਹ ਵਿਕਸਿਤ ਹੋਣਾ ਬੰਦ ਹੋ ਜਾਂਦਾ ਜਾਂ ਬਹੁਤ ਹੋਲੀ ਵਿਕਸਿਤ ਹੁੰਦਾ ਹੈ ਬੱਚਿਆਂ ਦੀ ਅੱਖਾਂ 'ਤੇ ਬਹੁਤ ਅਸਰ ਹੁੰਦਾ ਏ ਤੁਸੀਂ ਦੇਖਿਆ ਹੋਏਗਾ ਕੋਵਿਡ ਦੇ ਟਾਈਮ ਵੀ ਬੱਚਿਆਂ ਦੀ ਐਨਕਾਂ ਲੱਗ ਗਈਆਂ ਸਨ ਜਾਂ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਸੀ ਕਿਉਂਕਿ ਅਸੀਂ ਕਹਿੰਦੇ ਹਾਂ ਇਹਨੂੰ ਮੋਬਾਇਲ ਇੱਕ ਖਾਉ ਮੋਬਾਇਲ ਹੈ ਜੋ ਸਾਡਾ ਸਭ ਕੁਝ ਖਾ ਗਿਆ ਬੱਚਿਆਂ ਦੀ ਕਿਤਾਬਾਂ ਖਾ ਗਿਆ ਬੱਚਿਆਂ ਦਾ ਜਿਹੜਾ ਇੱਕ ਖੇਲ ਕੁੱਦਣ ਦਾ ਜਿਹੜਾ ਬੱਚਿਆਂ ਦਾ ਬਾਹਰ ਸੀ ਉਹ ਖਾ ਗਿਆ ਬੱਚੇ ਮਤਲਬ ਫਿਜ਼ੀਕਲ ਐਕਟੀਵਿਟੀ ਬੱਚਿਆਂ ਦੀ ਮੈਂਟਲ ਐਂਡ ਫਿਜ਼ੀਕਲ ਐਕਟੀਵਿਟੀ ਕਾਫੀ ਹੱਦ ਤੱਕ ਘੱਟ ਚੁੱਕੀ ਹੈ ਬੱਚੇ ਆਪਣਾ ਅਨਹੈਲਥੀ ਹੋ ਗਏ ਹੈ ਕਿਉਂਕਿ ਜਿੰਨਾਂ ਡਿਪਰੈਸ਼ਨ ਜਿੰਨੀ ਐਨਗਜ਼ਾਈਟੀ ਵੱਧੇਗੀ ਬੱਚਾ ਉਨੀ ਜਲਦੀ ਹੀ ਬੋਰ ਹੋ ਜਾਏਗਾ ਉਹਦਾ ਆਪਣੇ ਆਸ ਪਾਸ ਗੱਲ ਕਰਨ ਦਾ ਕਿਸੇ ਨੂੰ ਦਿਲ ਨਹੀਂ ਕਰੇਗਾ ਉਹ ਆਪਣੇ ਘਰਦਿਆਂ ਨਾਲ ਨਹੀਂ ਬੈਠੇਗਾ